ਧਾਰਮਿਕ ਤਿਉਹਾਰ ਨਾਲ ਸੰਬੰਧਿਤ ਖਾਣ ਪੀਣ ਦੀਆਂ ਕਈ ਚੀਜ਼ਾਂ ਹਨ ਜਿਵੇਂ ਕਿ ਲੋਹੜੀ ਜਿਸ ਦਿਨ ਗੰਨੇ ਦੀ ਰੋਹ ਪੀਤੀ ਜਾਂਦੀ ਹੈ ਅਤੇ ਰੋਹ ਦੀ ਖੀਰ ਖਾਧੀ ਜਾਂਦੀ ਹੈ ਜੋ ਕਿ ਬਹੁਤ ਹੀ ਪ੍ਰਸਿੱਧ ਹੈ ਉੱਦਾਂ ਹੀ ਇੱਕ ਤਿਉਹਾਰ ਹੈ ਦਿਵਾਲੀ ਜਿਸ ਦਿਨ ਮਿਠਾਈਆਂ ਖਾਧੀਆਂ ਜਾਂਦੀਆਂ ਹਨ ਅਤੇ ਜਲੇਬੀਆਂ ਖਾਧੀਆਂ ਜਾਂਦੀਆਂ ਹਨ ਅਤੇ ਆਪਣੇ ਪ੍ਰਿਯ ਲੋਕਾਂ ਨੂੰ ਤਿਉਹਾਰ ਦੇ ਰੂਪ 'ਤੇ ਉਪਹਾਰ ਦਿੱਤੇ ਜਾਂਦੇ ਹਨ ਫਿਰ ਇੱਕ ਮਸ਼ਹੂਰ ਤਿਉਹਾਰ ਜੋ ਕਿ ਸਾਡੇ ਕਲਚਰ ਵਿੱਚ ਮਨਾਇਆ ਜਾਂਦਾ ਹੈ ਨਵਾਂ ਸਾਲ ਜਿਸ ਉੱਤੇ ਨਹਾਇਆ ਜਾਂਦਾ ਹੈ ਅਤੇ ਨਵੇਂ ਕੱਪੜੇ ਪਾ ਕੇ ਆਪਣੇ ਸਰੀਰ ਨੂੰ ਸਜਾਇਆ ਜਾਂਦਾ ਹੈ ਅਤੇ ਆਪਣੇ ਖ਼ਾਸ ਯਾਰਾਂ ਦੋਸਤਾਂ ਨੂੰ ਤਿਉਹਾਰ ਪ੍ਰਸਤੁਤ ਕੀਤਾ ਜਾਂਦਾ ਹੈ ਇੱਦਾਂ ਹੀ ਹੋਰ ਵੀ ਬਹੁਤ ਤਿਉਹਾਰ ਹਨ ਜਿਵੇਂ ਕਿ ਮਾਘੀ ਜਿਸ ਦਿਨ ਕਿ ਇਕੱਲੀ ਖਿਚੜੀ ਖਾਧੀ ਜਾਂਦੀ ਹੈ ਧੰਨਵਾਦ